ਸਾਡੇ ਖੇਤਰ ਦੇ ਹਸਪਤਾਲਾਂ ਵਿੱਚ ਜਣੇਪਾ ਦੇਖਭਾਲ ਅਤੇ ਬੱਚਿਆਂ ਦੀ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਇੱਕ ਜਨਨੀ ਸੁਰੱਕਸ਼ਾ ਯੋਜਨਾ ਚੱਲ ਰਹੀ ਹੈ ਜਿਹਦੇ ਅੰ ਜਿਹਦੇ ਅੰਡਰ ਹੁੰਦਾ ਹੈ ਕਿ ਜੋ ਵੀ ਪ੍ਰੈਗਨੈਂਟ ਔਰਤਾਂ ਹੁੰਦੀਆਂ ਹਨ ਉਹਨਾਂ ਨੂੰ ਡਿਲੀਵਰੀ ਤੋਂ ਪਹਿਲਾਂ ਅਤੇ ਡਿਲੀਵਰੀ ਤੋਂ ਬਾਅਦ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੈ ਆ ਉਹ ਬਿਨਾਂ ਕਿਸੇ ਖ਼ਰਚੇ ਤੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਇਹਦੇ ਵਿੱਚ ਹੁੰਦਾ ਹੈ ਕਿ ਜੋ ਵੀ ਸਕੈਨ ਵਗੈਰਾ ਹੁੰਦੀਆਂ ਹੈ ਆ ਉਹਨਾਂ ਦੀਆਂ ਉਹ ਸਾਰੀਆਂ ਫਰੀ ਹੁੰਦੀਆਂ ਹੈ ਆ ਅਤੇ ਇਹਦੇ ਤੋਂ ਬਿਨਾਂ ਉਹਨਾਂ ਨੂੰ ਕੈਸ਼ ਦੇ ਵਿੱਚ ਜਿਹੜੀ ਆ ਉਹ ਵੀ ਹ ਜਿਹੜੀ ਹੈਲਪ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਆ ਇਹ ਤੋਂ ਬਿਨਾਂ ਜੋ ਆਸ਼ਾ ਵਰਕਰ ਹੁੰਦੇ ਹੈ ਨਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੀ ਟ੍ਰੇਨ ਕੀਤਾ ਜਾਂਦਾ ਹੈ ਤਾਂ ਕਿ ਉ ਜਦੋਂ ਤੱਕ ਜਿਹੜੇ ਆ ਹੋਸਪਿਟਲ ਦੀ ਕੋਈ ਵੀ ਐਬੂਲੈਂਸ ਵਗੈਰਾ ਨਹੀਂ ਪਹੁੰਚਦੀ ਤਾਂ ਉੱਨੇ ਟਾਈਮ ਤੱਕ ਉਹ ਜਿਹੜੀਆਂ ਪ੍ਰੈਗਨੈਂਟ ਔਰਤਾਂ ਹੁੰਦੀਆਂ ਹੈ ਉਹਨਾਂ ਦੀ ਦੇਖਭਾਲ ਕਰ ਸਕਦੀਆਂ ਹੈ ਅਤੇ ਉਹਨਾਂ ਨੂੰ ਹੋਸਪਿਟਲ ਜਿਹੜਾ ਹੈ ਫਿਰ ਉਹ ਲੈ ਕੇ ਜਾ ਸਕਦੀਆਂ ਹੈ ਆ ਇਸ ਤੋਂ ਬਿਨਾਂ ਹੁੰਦਾ ਹੈ ਕਿ ਜਿੰਨਾ ਟਾਈਮ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਜੋ ਔਰਤ ਹੈ ਜਿਹਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਬੱਚਾ ਬਿਲਕੁਲ ਠੀਕ ਠਾਕ ਨਹੀਂ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਹੀ ਰੱਖਿਆ ਜਾਂਦਾ ਹੈ ਆ ਅਤੇ ਉਹਨਾਂ ਨੂੰ ਉੱਨੇ ਟਾਈਮ ਤੱਕ ਸਾਰੀਆਂ ਦੀਆਂ ਸਾਰੀਆਂ ਜੋ ਮੈਡੀਕਲ ਅ ਸਹੂਲਤਾਂ ਹੁੰਦੀਆਂ ਹੈ ਆ ਉਹਨਾਂ ਨੂੰ ਫ੍ਰੀ ਵਿੱਚ ਦਿੱਤੀਆਂ ਜਾਂਦੀਆਂ ਹੈ ਅਤੇ ਉਹਨਾਂ ਦੇ ਕੋਲੋਂ ਇਸ ਲਈ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਅਤੇ ਸਰਕਾਰ ਵਲੋਂ ਸੱਤ ਸੌ ਪੰਜਾਹ ਰੁਪਏ ਪ੍ਰਤੀ ਮਹੀਨਾ ਜਿਹੜਾ ਹੈ ਆ ਉਹ ਉਹਨਾਂ ਔਰਤਾਂ ਨੂੰ ਦਿੱਤਾ ਜਾਂਦਾ ਆ ਤਾਂ ਕਿ ਉਹ ਆਪਣੀ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਣ